ਬਾਈਕ ਬਾਈਕ ਇੱਕ ਆਰਾਮਦਾਇਕ ਵਹੀਕਲ ਹੈ ਜਿਸ ਨੂੰ ਚਲਾਉਣ ਵਿੱਚ ਕਾਫ਼ੀ ਆਸਾਨੀ ਹੁੰਦੀ ਹੈ ਆਮ ਬੰਦਾ ਅਤੇ ਔਰਤਾਂ ਵੀ ਇਸ ਨੂੰ ਨਾ ਨੋਰ ਆਮ ਚਲਾ ਸਕਦੀਆਂ ਹਨ ਇਹ ਇੱਕ ਤਾਂ ਥਾਂ ਘੱਟ ਘੇਰਦਾ ਹੈ ਦੂਸਰਾ ਆਰਾਮਦਾਇਕ ਸਵਾਰੀ ਹੈ ਨੋਰਮਲ ਰੂਟ ਨੋਰਮਲ ਆਮ ਤੌਰ 'ਤੇ ਅਤੇ ਲੰਬੇ ਸਫ਼ਰ ਲਈ ਇਹ ਵਧੀਆ ਹੈ ਇਸ ਉੱਤੇ ਜਾਣ ਵਾਸਤੇ ਦੋ ਜਣੇ ਆਰਾਮ ਨਾਲ ਬੈਠ ਕੇ ਜਾ ਸਕਦੇ ਨੇ ਬਾਜ਼ਾਰ ਵਿੱਚ ਜ਼ਿਆਦਾ ਭੀੜ ਭੜੱਕੇ ਏਰੀਏ ਵਿੱਚ ਆਰਾਮ ਨਾਲ ਚਲਾ ਜਾਂਦਾ ਹੈ ਅਤੇ ਉੱਥੇ ਥਾਂ ਵੀ ਘੱਟ ਘੇਰਦਾ ਹੈ ਇਸ ਨੂੰ ਖੜਾ ਕਰਨ ਲਈ ਜ਼ਿਆਦਾ ਕੋਈ ਦਿੱਕਤ ਨਹੀਂ ਆਉਂਦੀ ਦੁਕਾਨਾਂ ਉੱਤੇ ਆਮ ਹੀ ਖੜੇ ਹੋ ਜਾਂਦੇ ਹਨ ਅਤੇ ਛੋਟੀਆਂ ਗਲੀਆਂ ਵਿੱਚੋਂ ਵੀ ਇਹ ਆਰਾਮ ਨਾਲ ਚਲਾ ਜਾਂਦਾ ਹੈ ਭਵਿੱਖ ਵਿੱਚ ਇਸਦੇ ਬਹੁਤ ਫ਼ਾਇਦੇ ਹਨ ਕਿਉਂਕਿ ਜਿੰਨੀ ਭਾਰਤ ਦੀ ਜਨਸੰਖਿਆ ਵੱਧ ਰਹੀ ਹੈ ਵੱਡੀਆਂ ਗੱਡੀਆਂ ਨਾਲ ਯਾਤਰਾ ਕਰਨੀ ਔਖੀ ਹੈ ਛੋਟੇ ਵਹੀਕਲਾਂ ਦੇ ਉੱਤੇ ਈਜੀ ਰਹਿ ਨੋਰਮਲ ਆਦਮੀ ਆਰਾਮ ਨਾਲ ਚਲਾ ਸਕਦਾ ਹੈ